ਨਮਸਕਾਰ ਜੀ ਮੈਨੂੰ ਜੀ ਇੱਕ ਫੋਨ ਆਇਆ ਹੈ ਜੀ ਕਸਟਮਰ ਕੇਅਰ ਤੋਂ ਜੀ ਕਸਟਮਰ ਕੇਅਰ ਦਾ ਜੀ ਬਿੱਲ ਭੁਗਤਾਨ ਬਾਰੇ ਕਹਿ ਰਹੇ ਸੀ ਪਰ ਉਹਨਾਂ ਨੇ ਮੇਰੇ ਫੋਨ 'ਤੇ ਐਕਸਟ੍ਰਾ ਸਰਵਿਸ ਜੋ ਕਿ ਵੈਲਿਊ ਐਡਿਡ ਸਰਵਿਸ ਹੁੰਦੀਆਂ ਨੇ ਬਹੁਤ ਸਾਰੀਆਂ ਇੱਕ ਨਹੀਂ ਇੱਕ ਤੋਂ ਵੱਧ ਲਗਾਈਆਂ ਹੋਈਆਂ ਸੀ ਜੋ ਕਿ ਮੈਂ ਨਹੀਂ ਲਗਾਈਆਂ ਸੀ ਉਹਨਾਂ ਦਾ ਸਾਰਾ ਡਾਟਾ ਬਣਾ ਕੇ ਮੈਨੂੰ ਬਿੱਲ ਦੇ ਬਾਰੇ ਵੇਰਵੇ ਬਾਰੇ ਦੱਸ ਰਹੇ ਸੀ ਜੋ ਕਿ ਮੈਂ ਨੋਟ ਕੀਤਾ ਕਿ ਮੈਂ ਇਹ ਚੀਜ਼ਾਂ ਨਹੀਂ ਲਗਾਈਆਂ ਜਦੋਂ ਮੈਂ ਬਿੱਲ ਦੇਖਿਆ ਆਪਣਾ ਬਿੱਲ ਵਿੱਚ ਇਹ ਸਾਰਿਆਂ ਦਾ ਦਸ ਵੈਲਿਊ ਐਡਿਡ ਸਰਵਿਸ ਦਾ ਜ਼ਿਕਰ ਸੀ ਮੈਂ ਤੁਰੰਤ ਆਪਣੇ ਕਸਟਮਰ ਅਧਿਕਾਰੀ ਜੋ ਔਨਲਾਈਨ ਕੌਲ ਕੀਤੀ ਮੈਂ ਟੋਲ ਫਰੀ 'ਤੇ ਉਹਨਾਂ ਨੂੰ ਇਹਨਾਂ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਕਿ ਇਹ ਵੈਲਿਊ ਐਡਿਡ ਸਰਵਿਸ ਮੇਰੇ ਦੁਆਰਾ ਨਹੀਂ ਲਗਾਈਆਂ ਗਈਆਂ ਤਾਂ ਜੋ ਮੇਰਾ ਬਿੱਲ ਹੈ ਉਸ ਵਿੱਚ ਡਿਸਕਾਊਂਟ ਕਰਕੇ ਮੈਨੂੰ ਪ੍ਰੋਪਰ ਬਿੱਲ ਜੋ ਬਣਦਾ ਹੈ ਉਹ ਮੈਂ ਦੇਵਾਂ ਇਸ ਨਾਲ ਜੋਕਰ ਜੇਕਰ ਇਸ ਤਰ੍ਹਾਂ ਦੀ ਸਰਵਿਸ ਲੱਗਦੀਆਂ ਨੇ ਇਹਨਾਂ ਨੂੰ ਪਹਿਲਾਂ ਸਾਨੂੰ ਵੇਰਵਿਆਂ ਬਾਰੇ ਸਾਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਅਸੀਂ ਅੱਗੇ ਨੈਕਸਟ ਬਿੱਲ ਬਾਰੇ ਜਾਣ ਸਕੀਏ ਇਸ ਤੋਂ ਇਲਾਵਾ ਜੇਕਰ ਸਾਨੂੰ ਬਿੱਲ ਵੈਲਿਊ ਐਡਿਡ ਸਰਵਿਸਾਂ ਨਹੀਂ ਦਿੱਤੀਆਂ ਜਾਂਦੀਆਂ ਜੇਕਰ ਅਸੀਂ ਲਗਾਈਆਂ ਹੀ ਨਹੀਂ ਜਕ ਜੋ ਸਾਨੂੰ ਅਣ ਵੈਲਿਊਏਬਲ ਜੇਕਰ ਆਪਾਂ ਯੂਜ਼ ਹੀ ਨਹੀਂ ਕਰਨੀਆਂ ਉਸ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਬਿੱਲ ਸਾਡੇ ਤੋਂ ਲੋੜ ਤੋਂ ਵੱਧ ਨਜਾਇਜ਼ ਹੀ ਪਾ ਦਿੱਤਾ ਗਿਆ ਜੋ ਕਿ ਬਹੁਤ ਮਾੜੀ ਗੱਲ ਹੈ ਟੈਲੀਫੋਕ ਕੰਪਨੀਆਂ ਲਈ ਇਸ ਤੋਂ ਇਲਾਵਾ ਅਸੀਂ ਜੋ ਬਿੱਲ ਪੇਅ ਕਰਦੇ ਹਾਂ ਉਹਦੀ ਰਸਿਪਟ ਲੈਣਾ ਵੀ ਜ਼ਰੂਰੀ ਲਾਜ਼ਮੀ ਕਰਨਾ ਚਾਹੁੰਦੇ ਹਾਂ ਪਲੀਜ਼ ਰਿਕੁਐਸਟ ਹੈ ਜੀ ਸਾਰਿਆਂ ਨੂੰ ਇਸ ਤਰ੍ਹਾਂ ਦੇ ਟੈਲੀਕੋਮ ਜੋ ਕੰਪਨੀਆਂ ਬਿੱਲ ਵੇਰਵਿਆਂ ਬਾਰੇ ਸਾਨੂੰ ਦੱਸਦੀ ਹੈ ਉਹਨਾਂ ਤੋਂ ਪਹਿਲਾਂ ਡਾਟਾ ਸਾਰਾ ਮੰਗਵਾਓ ਕਿਹੜੀ ਬਿੱਲ ਕਿਸ ਕਿਤ ਕਿੰਨਾ ਕੌਲਿੰਗ 'ਤੇ ਕਿੰਨਾ ਐੱਸ ਐੱਮ ਐੱਸ 'ਤੇ ਬਿੱਲ ਚਾਰਜ ਕੀਤਾ ਗਿਆ ਹੈ